ਰੂਪਨਗਰ ਜ਼ਿਲ੍ਹੇ ਵਿੱਚ ਆਲੂ ਦਾ ਪਰੌਂਠਾ ਬਹੁਤ ਮਸ਼ਹੂਰ ਹੈ ਇਸ ਦੀ ਵਿਧੀ ਬਣਾਉਣ ਦੀ ਸਮੱਗਰੀ ਹੈ ਜੋ ਆਲੂ ਉਬਾਲੇ ਜਾਂਦੇ ਨੇ ਫਿਰ ਉਸ ਵਿੱਚ ਮਸਾਲੇ ਪਾਏ ਜਾਂਦੇ ਨੇ ਬਹੁਤ ਅੱਛੇ ਪਰੌਂਠੇ ਬਣਦੇ ਹੈ ਲੋਕ ਖੁਸ਼ ਹੋ ਕੇ ਖਾਂਦੇ ਨੇ ਉਸ ਤੋਂ ਬਾਅਦ ਛੋਲੇ ਪੂਰੀ ਖਾਂਦੇ ਨੇ ਸਵੇਰੇ ਸਵੇਰੇ ਅਤੇ ਉਸ ਤੋਂ ਬਾਅਦ ਫਿਰ ਹੋਟਲਾਂ ਦੇ ਵਿੱਚ ਦਾਲ਼ ਮੱਖਣੀ ਅਤੇ ਕੜੀ ਚਾਵਲ ਬਹੁਤ ਚੱਲਦਾ ਹੈ ਖੁ ਲੋਕ ਖੁਸ਼ ਹੋ ਕੇ ਖਾਂਦੇ ਨੇ ਹੋਟਲ ਬਹੁਤ ਅੱਛੇ ਅੱਛੇ ਨੇ ਜਿੱਥੇ ਵੀ ਮਿਲਦਾ ਹੈ ਬੈਠ ਕੇ ਖਾ ਲੈਂਦੇ ਆ